ਹੈਲੋ ਸਰ ਮੈਂ ਅੱਧੇ ਘੰਟੇ ਪਹਿਲਾਂ ਇੱਕ ਜੋਮੈਟੋ ਤੋਂ ਆਰਡਰ ਕੀਤਾ ਸੀ ਹਾਲੇ ਤੱਕ ਮੇਰੇ ਕੋਲ ਪਹੁੰਚਿਆ ਹੀ ਨਹੀਂ ਹੈ ਮੈਂ ਉਹਦੇ ਵਿੱਚ ਪਿਜ਼ਾ ਔਡਰ ਕੀਤਾ ਸੀ ਤੁਸੀਂ ਕਿੱਥੇ ਜਿਹੇ ਪਹੁੰਚ ਗਏ ਅਤੇ ਕਿੰਨਾ ਟਾਈਮ ਹੋਰ ਲੱਗੇਗਾ ਤੁਹਾਨੂੰ ਪਲੀਜ਼ ਮੈਨੂੰ ਛੇਤੀ ਦੱਸ ਦਿਓ ਮੈਂ ਕਦੋਂ ਦੀ ਵੇਟ ਕਰ ਰਹੀ ਹਾਂ ਅਤੇ ਹਾਲੇ ਤੱਕ ਤੁਹਾਡਾ ਕੁਛ ਜੀ ਪੀ ਐਸ ਦਾ ਵੀ ਕੁਛ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਕਿੱਥੇ ਪਹੁੰਚੇ ਹੋ ਮੈਨੂੰ ਇਗਜ਼ੈਕਟ ਜਿਹੜਾ ਹੈਗਾ ਉਹ ਟਾਈਮ ਦੱਸ ਦਿਓ ਤਾਂ ਕਿ ਮੈਂ ਜੋ ਆ ਮਤਲਬ ਉਡੀਕ ਕਰਨ ਦੇ ਵਿੱਚ ਸਮਰਥ ਹੋਜਾਂ ਕਿ ਮੈਨੂੰ ਤੁਹਾਨੂੰ ਹੁਣ ਇੰਨਾ ਟਾਈਮ ਹੋਰ ਲੱਗਣਾ ਮੈਨੂੰ ਕਦੋਂ ਦਾ ਦਿਖਾ ਰਹੇ ਹੈ ਕਿ ਦਸ ਮਿੰਟ ਤੱਕ ਆਜੋਗੇ ਆਜੋਗੇ ਆਜੋਗੇ ਪਰ ਹਾਲੇ ਤੱਕ ਤੁਸੀਂ ਆਏ ਨਹੀਂ ਹੋਰ ਕਿੰਨੇ ਕੁ ਦੇਰ ਲੱਗੇਗੀ ਸਰ ਕਿਉਂਕਿ ਮੈਨੂੰ ਆਰਡਰ ਕੀਤੇ ਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਜੇ ਹੋਰ ਵੀ ਟਾਈਮ ਲੱਗਣਾ ਤਾਂ ਮੈਨੂੰ ਦੱਸ ਦਿਓ ਮੈਂ ਜੋਮੈਟੋ ਤੋਂ ਬਹੁਤ ਵਾਰੀ ਆਰਡਰ ਕੀਤਾ ਅਤੇ ਇੰਨੀ ਦੇਰ ਤਾਂ ਕਦੇ ਵੀ ਨਹੀਂ ਲੱਗੀ ਐਤਕੀ ਵਾਰ ਤਾਂ ਤੁਸੀਂ ਬਹੁਤ ਜ਼ਿਆਦਾ ਦੇਰ ਲਾਤੀ ਜਾਂ ਤੁਸੀਂ ਇਕੱਠੇ ਆਰਡਰ ਚੱਕੇ ਨੇ ਕਿਸੇ ਹੋਰ ਨੂੰ ਵੀ ਦੇਣਾ ਪਲੀਜ਼ ਮੈਨੂੰ ਐਗਜੈਕਟ ਟਾਈਮ ਦੱਸ ਦਿਓ ਜ਼ਿਆਦਾ ਲੇਟ ਨਾ ਕਰੋ ਪਲੀਜ਼